ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਜੀ ਕੀ ਸੇਵਾ ਕਰ ਸਕਦੇ ਹਾਂ ਆਪਾਂ ਤਾਂ ਹਾਂਜੀ ਹਾਂਜੀ ਹਾਂਜੀ ਤੁਸੀਂ ਕਿਹੜੇ ਏਅਰਪੋਰਟ 'ਤੇ ਆਏ ਜੀ ਜੀ ਜੀ ਜੀ ਕਿਹੜੀ ਇੱਧਰ ਅੰਮ੍ਰਿਤਸਰ ਵਾਲੀ ਸਾਈਡ 'ਤੇ ਕਿ ਪਠਾਣਕੋਟ ਹਾਂਜੀ ਹਾਂਜੀ ਭਾਅ ਜੀ ਇੱਥੋਂ ਨਾ ਇੱਕ ਸਵੇਰੇ ਪੰਜ ਵਜੇ ਬੱਸ ਜਾਂਦੀ ਜੇ ਹਾਂਜੀ ਹਾਂਜੀ ਅੰਮ੍ਰਿਤਸਰ ਨੂੰ ਬੱਸ ਜਾਂਦੀ ਹੈ ਤੁਸੀਂ ਸਾਰੇ ਫੈਮਲੀ ਜਾਂ ਤਾਂ ਬੱਸ 'ਚ ਬਹਿ ਜਾਓ ਜਾਂ ਫਿਰ ਟ੍ਰੇਨ ਦਾ ਸਮਾਂ ਹੈਗਾ ਜੀ ਸੱਤ ਵਜੇ ਮੈਂ ਤੁਹਾਨੂੰ ਮੇਰੇ ਹਿਸਾਬ ਹਾਂਜੀ ਟਰੇਨ ਸਹੀ ਜੇ ਏਸੀ ਵਾਲੀ ਟਿਕਟ ਲੈ ਲਿਓ ਬਹੁਤ ਕੰਫਰਟੇਬਲ ਆ ਅਤੇ ਭਾਅ ਜੀ ਨਾਲੇ ਅੰਮ੍ਰਿਤਸਰ ਜੇ ਜਾਓਗੇ ਜਾਓਗੇ ਤਾਂ ਗੋਲਡਨ ਟੈਂਪਲ ਜ਼ਰੂਰ ਜਾਇਓ ਦਰਬਾਰ ਸਾਹਿਬ ਭਾਅ ਜੀ ਉਹਨੇ ਤੁਹਾਨੂੰ ਤਿੰਨਾਂ ਤਿੰਨ ਆਰਸ ਤਿੰਨਾਂ ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਓਹਨੇ ਅੰਮ੍ਰਿਤਸਰ ਲਾ ਦੇਣਾ ਪਠਾਣਕੋਟ ਤੋਂ ਅਤੇ ਕੋਈ ਨਹੀਂ ਚਿੰਤਾ ਹਾਂਜੀ ਹਾਂਜੀ ਭਾਅ ਜੀ ਉੱਥੇ ਨਾ ਆਟੋ ਰਿਕਸ਼ੇ ਵਾਧੂ ਖੜ੍ਹੇ ਹੁੰਦੇ ਨੇ ਤੁਸੀਂ ਆਟੋ ਰਿਕਸ਼ੇ ਬਹਿ ਸਕਦੇ ਜੀ ਇੱਕ ਸੇਵਾ 'ਤੇ ਬੱਸ ਵੀ ਲੱਗੀ ਹੁੰਦੀ ਹੈ ਜੇ ਦਰਬਾਰ ਸਾਹਿਬ ਤੁਸੀਂ ਜਾਣਾ ਹੋਵੇ ਅਤੇ ਤੁਸੀਂ ਬੱਸ 'ਚ ਬਹਿ ਸਕਦੇ ਜੇ ਹਾਂਜੀ ਅਤੇ ਜੇ ਭਾਅ ਜੀ ਹੋਰ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇਗੀ ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਲਿਓ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਚੌਵੀ ਘੰਟੇ ਬਹੁਤ ਧੰਨਵਾਦ ਜੀ ਧੰਨਵਾਦ